ਹਾਂਜੀ ਸਾਡੇ ਨਵਜੰਮੇ ਬੱਚੇ ਨੂੰ ਪਹਿਲਾਂ ਤਾਂ ਘਰ ਲਿਆ ਕੇ ਮੱਥਾ ਟਿਕਾਇਆ ਜਾਂਦਾ ਹੈ ਫਿਰ ਬੱਚੇ ਦੀ ਸਾਂਭ ਸੰਭਾਲ ਲਈ ਰੂਮ ਤਿਆਰ ਕੀਤਾ ਜਾਂਦਾ ਹੈ ਅਤੇ ਅਲੱਗ ਕੱਪੜੇ ਲਿਆਂਦੇ ਜਾਂਦੇ ਹਨ ਅਤੇ ਬੱਚੇ ਨੂੰ ਅਸੀਂ ਜ਼ਿਆਦਾਤਰ ਮੂੰਹ ਮੂੰਹ ਵੀ ਨਹੀਂ ਲਾਉਂਦੇ ਅਤੇ ਉਸਦੀ ਕੇਅਰ ਲਈ ਅਸੀਂ ਬੇਬੀ ਕੇਅਰ ਵਰਤਦੇ ਹਾਂ ਅਤੇ ਉਸ ਨੂੰ ਸਾਂਭ ਸੰਭਾਲ ਲਈ ਅਸੀਂ ਜ਼ਿਆਦਾ ਬੱਚਿਆਂ ਨੂੰ ਵੀ ਨਹੀਂ ਫੜਾਉਂਦੇ ਅਤੇ ਸਾਡੇ ਉਸ ਤੋਂ ਬਾਅਦ ਜੋ ਸਵਾ ਮਹੀਨੇ ਦਾ ਬੱਚਾ ਹੋ ਜਾਂਦਾ ਤਾਂ ਉਦੋਂ ਅਸੀਂ ਉਸ ਨੂੰ ਬਾਹਰ ਵਧਾਉਂਦੇ ਹਾਂ ਅਤੇ ਜਦੋਂ ਪਹਿਲੇ ਦਿਨ ਬੱਚਿਆਂ ਨੂੰ ਲੈ ਕੇ ਆਉਂਦਾ ਹੈ ਤਾਂ ਉਦੋਂ ਅਸੀਂ ਪਾਥੀ ਬਾਲਦੇ ਹਾਂ ਅਤੇ ਜਦੋਂ ਮੰਨ ਕੇ ਚਲੋ ਬਾਹਰ ਵਧਾਉਂਦੇ ਹਾਂ ਤਾਂ ਸਾਡੇ ਮਹੰਤ ਆ ਕੇ ਨੱਚ ਕੇ ਜਾਂਦੇ ਹਨ ਅਤੇ ਸਰੀਂਹ ਬੰਨ੍ਹਦੇ ਹਾਂ ਅਤੇ ਮਹੰਤਾਂ ਨੂੰ ਵਧਾਈ ਦਿੰਦੇ ਹਾਂ ਅਸੀਂ ਅਤੇ ਲੋਹੜੀ ਅਸੀਂ ਬਹੁਤ ਧੂਮਧਾਮ ਨਾਲ ਮਨਾਉਂਦੇ ਹਾਂ ਬੱਚੇ ਦੀ ਪਹਿਲੀ ਪਹਿਲੀ ਲੋਹੜੀ 'ਚ ਅਸੀਂ ਬੱਚੇ ਨੂੰ ਪਹਿਲਾਂ ਮੱਥਾ ਟਿਕਾਇਆ ਜਾਂਦਾ ਹੈ ਉਸ ਤੋਂ ਬਾਅਦ ਮਹੰਤਾਂ ਨੂੰ ਬੁਲਾਇਆਂ ਜਾਂਦਾ ਹੈ ਉਸ ਨੂੰ ਸ਼ਗਨ ਸਲਾਮੀਆਂ ਦਿੱਤੀਆਂ ਜਾਂਦੀਆਂ ਹਨ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਫਿਰ ਅਸੀਂ ਲੋਹੜੀ 'ਤੇ ਲੱਕੜਾਂ ਪਾਥੀਆਂ ਤੇਲ ਐਰਾ ਵਗੈਰਾ ਜੋ ਵੀ ਸਮਾਨ ਹੁੰਦਾ ਹੈ ਅਸੀਂ ਉਹਨਾਂ ਨੂੰ ਇਕੱਠਾ ਕਰਕੇ ਅ ਅੱਗ ਲਾ ਕੇ ਸੱਤ ਪਰਿਕਰਮਾ ਕਰਦੇ ਹਾਂ ਅਤੇ ਬੱਚੇ ਦਾ ਹੱਥ ਲਵਾ ਕੇ ਪਰਿਕਰਮਾ ਕਰਕੇ ਉਸ ਤੋਂ ਬਾਅਦ ਲੋਹੜੀ ਬਾਲਦੇ ਹਾਂ ਅਸੀਂ ਢੋਲ ਡੀ ਜੇ ਵੂਫਰ ਵਗੈਰਾ ਲਾ ਕੇ ਰਸਮ ਰਸਮ ਨੂੰ ਪੂਰਾ ਕਰਦੇ ਹਾਂ ਅਤੇ ਦੀਵਾਲੀ ਵੀ ਅਸੀਂ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ ਦੀਵਾਲੀ ਵਿੱਚ ਅਸੀਂ ਪਹਿਲਾਂ ਤਾਂ ਮੰਦਿਰ ਜਾ ਕੇ ਮੱਥਾ ਟਿਕਾਉਂਦੇ ਹਾਂ ਬੱਚੇ ਦਾ ਉਸ ਤੋਂ ਬਾਅਦ ਘਰ ਦੀਵੇ ਜਲਾਉਂਦੇ ਹਾਂ ਦੀਵੇ ਜਲਾ ਕੇ ਅਤੇ ਵੱਡਿਆਂ ਦਾ ਆਸ਼ੀਰਵਾਦ ਲੈਂਦੇ ਹਾਂ ਬੱਚੇ ਨੂੰ ਵਧੀਆ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਵੀ ਸਮਾਨ ਹੁੰਦਾ ਹੈ ਉਹ ਆਂਢ ਗੁਆਂਢ ਵਿੱਚ ਵੰਡਿਆ ਜਾਂਦਾ ਹੈ ਅਤੇ ਜਿਹੜੀ ਵੀ ਕੋਈ ਵੀ ਰਸਮ ਹੁੰਦੀ ਹੈ ਉਹ ਅਸੀਂ ਬੜੀ ਧੂਮਧਾਮ ਨਾਲ ਬੱਚੇ ਦੀ ਮਨਾਈ ਜਾਂਦੀ ਆ ਅਤੇ ਕਈ ਵਾਰ ਬੱਚੇ ਨੂੰ ਸੋਨਾ ਵੀ ਪਾਇਆ ਜਾਂਦਾ ਹੈ ਨਾਨਕੇ ਜੋ ਵੀ ਲੀੜਾ ਕੱਪੜਾ ਮਹਿੰਗੇ ਲੈ ਕੇ ਆਉਂਦੇ ਹਨ ਉਹ ਸਾਰਾ ਬੱਚੇ ਲਈ ਦਿਨ ਤਿਉਹਾਰਾਂ 'ਤੇ ਲਿਆਇਆ ਜਾਂਦਾ ਹੈ ਅਤੇ ਅਤੇ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ